ਦੀ ਵਿਕਰੀ ਵੱਧ ਰਹੀ ਹੈ ਅਤੇ ਫੂਡ ਪ੍ਰੋਸੈ ਪ੍ਰੋਸੈਸਿੰਗ ਉਹਦੀ ਉਹਦੇ ਵਿੱਚ ਪੀਕਲ 'ਚ ਰੈਡੀ ਟੂ ਈਟ ਮੀਲਸ ਡੇਅਰੀ ਪ੍ਰੋਡਕਟਸ ਅਤੇ ਕਈ ਸਾਰੀਆਂ ਮੰਗ ਲਾ ਮੰਗ ਲਗਾਤਾਰ ਵੱਧ ਰਹੀਆਂ ਹਨ ਕਾਲ ਕਾਲੰਟ ਸ਼ ਟੈ ਸਟੋਰੇਜ ਕਾਲੰਟ ਸਟੋਰੇਜ ਕਲਾਊਡ ਸਟੋਰੇਜ ਅਤੇ ਵੈ ਅਤੇ ਫਰੈਸ਼ ਪ੍ਰੋਡਿਊਸ ਬੈਰਿਮ ਮੀਟ ਸਟੋਰੇਜ ਦੇ ਖੇਤਰ 'ਚ ਨਵੀਆਂ ਬਿਜ਼ਨਸ ਓਪਰਚਿਊਨਟੀਆਂ ਵੱਧ ਰਹੀਆਂ ਹਨ ਠੀਕ ਆ ਹੋਮ ਕੈਰੀਅਰ ਅਤੇ ਉਪਯੋਗਤਾ ਉਤਪਾਦ ਲਈ ਕਈ ਸਾਰੇ ਕਈ ਸਾਰੇ ਓਪਰਚਿਊਨਟੀਆਂ 'ਚ ਹਨ ਜਿੱਦਾਂ ਕੀ ਡੀਟਰਜੈਂਟ ਪਾਊਡਰ ਉਤਪਾਦਨ ਇਹਦੇ ਵਿੱਚ ਘੱਟ ਲ ਲਾਗਤ ਅਤੇ ਵੱਧ ਮੰਗ ਬਾਲ ਵਾਲਾ ਕਾਰੋਬਾਰ ਜੋ ਪੰਜਾਬ 'ਚ ਆਸਾਨੀ ਨਾਲ ਚੱਲ ਸਕਦਾ ਹੈ ਅਤੇ ਇਹਦੇ ਵਿੱਚ ਸਪੈਸੇਟੇ ਸਪੈਸ਼ਲੀਟੀ ਸੋਪ ਮੇਕਿੰਗ ਆ ਜਾਂਦੇ ਆ ਜਿੱਦਾਂ ਕਿ ਹਰਬਲ ਸੋਪਸ ਆ ਜਾਂਦਾ ਹੈ ਆਯੂਰਵੈਦਿਕ ਸਪੋ ਸੋਪਸ ਆ ਜਾਂਦਾ ਸਕਿਨ ਕੇਅਰ ਪ੍ਰੋਡਕਟ ਆ ਜਾਂਦੇ ਆ ਦੀ ਮੰਗ ਇਹਦੀ ਇਹਨਾਂ ਦੀ ਵਰਤੋਂ ਕਈ ਸਾਰੇ ਇਹਨਾਂ ਦੀ ਮੰਗ ਤੇਜੀ ਨਾਲ ਵੱਧ ਰਹੀ ਹੈ ਅਤੇ ਇੱਕ ਆ ਗਿਆ ਇਕੋਫਰੈਂਡਲੀ ਉਤਪਾਦ ਜਿਹਦੇ ਵਿੱਚ ਕੈਮੀਕਲ ਫਰੀ ਆ ਜਾਂਦੇ ਹਨ ਔਰਗੈਨਿਕ ਡਿਟਰਜੈਂਟ ਆ ਜਾਂਦੇ ਹਨ ਅਤੇ ਇਹਦੀ ਮੰਗ ਇਹਨਾਂ ਦੀ ਵੀ ਮੰਗ ਕਈ ਸਾਰੇ ਨਵੀਆਂ ਉਚਾਂ ਉਚਾਈਆਂ ਛੂਹ ਰਹੀਆਂ ਹਨ ਅਤੇ ਕਈ ਸਾਰੇ ਆ ਜਾਂਦੇ ਹਨ ਜਿੱਦਾਂ ਕੀ ਆਈਟੀ ਅਤੇ ਸਾਰਾ ਇਕੋਸਿਸਟਮ ਆ ਜਾਂਦਾ ਹੈ ਜਿਹਦੇ ਵਿੱਚ ਸੋਫਟਵੇਅਰ ਡਿਵੈਲਪਮੈਂਟ ਹੈ ਬਿਜਨੈਸ ਇਹ ਵੀ ਬਹੁਤ ਜ਼ਿਆਦਾ ਮਜ਼ਬੂਤ ਸਟਾਰਟਅੱਪਸ ਵੱ ਵੱਧ ਰਿਹਾ ਹੈ ਕਲਾਉਡ ਲਿਸਟਿੰਗ ਡਾਟਾ ਪ੍ਰੋਟੈਕਸ਼ਨ ਹਾਈ ਟੈਕ ਪਲੇਟਫਾਰਮ ਪੰਜਾਬ 'ਚ ਵਿਕਾਸ ਇਹ ਸਾਰੀਆਂ ਇਹ ਸਾਰੀਆਂ ਪਲੇਟਫਾਰਮਾਂ ਸਿਲੀਉਸ਼ਨਲ ਸਰਵਿਸਸ ਸਾਰੀਆਂ ਪੰਜਾਬ 'ਚ ਵਿਕਾਸ ਕਰ ਰਹੀਆਂ ਹਨ ਪੰਜਾਬ ਦੇ ਖੇਤੀਬਾੜੀ ਉਦਯੋਗ ਡਿਜੀਟਲ ਵਪਾਰ ਅਤੇ ਨਵੀਂ ਟੈਕਨੋਲੋਜੀ ਦੇ ਨਾਲ ਵਧੀਆ ਕਾਰੋਬਾਰ ਸ਼ੁਰੂ ਕਰਨਾ ਸੰਭਵ ਹੈ ਔਰਗੈਨਿਕ ਫਾਰਮਿੰਗ ਫੂਡ ਪ੍ਰੋਸੈਸਿੰਗ ਈ ਕਾਮਰਸ ਡੀਜੀਟਲ ਫਾਰਮ ਸਰਵਿਸਿਸ ਵਰਗੇ ਖੇਤਰ ਭਵਿੱਖ 'ਚ ਵੱਡੇ ਉਤਸਾ ਉਤਸਾਹ ਦੇਣ ਉਤਸਾਹ ਵਧੀਆ ਹਨ ਧੰਨਵਾਦ